ਮੈਨੂੰ ਬੁਣਾਈ ਸਿੱਖਣ ਦੀ ਪ੍ਰੇਰਨਾ ਸਾਡੇ ਪਰਿਵਾਰ ਵਿੱਚੋਂ ਹੀ ਮਿਲੀ ਜਿਵੇਂ ਮੇਰੀ ਦਾਦੀ ਭੂਆ ਮੰਮੀ ਸਾਰੇ ਸਵੈਟਰ ਬਣਾਉਂਦੇ ਸੀ ਅਤੇ ਮੈਂ ਵੀ ਉਨ੍ਹਾਂ ਕੋਲੋਂ ਦੇਖ ਕੇ ਬਨਾਉਣਾ ਸ਼ੁਰੂ ਕਰ ਤਾ ਮੈਂ ਕਿਸੇ ਦੋਸਤ ਜਾਂ ਗੁਰੂ ਕੋਲੋਂ ਨਹੀਂ ਸਿੱਖਿਆ ਸਿੱਖਿਆ ਆਪਣੇ ਆਪ ਉਨ੍ਹਾਂ ਵੱਲ ਦੇਖ ਦੇਖ ਕੇ ਮੈਨੂੰ ਆ ਗਿਆ ਇਹਦੀ ਇਹਦੀ ਪ੍ਰਕਿਰਿਆ ਸਭ ਤੋਂ ਵੱਡੀ ਇਹ ਸੀ ਕਿ ਮੈਂ ਸਭ ਤੋਂ ਪਹਿਲੇ ਸਵੈਟਰ ਆਪਣੇ ਪਿਤਾ ਜੀ ਲਈ ਬਣਾਇਆ ਜਿਹੜਾ ਉਨ੍ਹਾਂ ਨੂੰ ਬੜਾ ਪਸੰਦ ਆਇਆ ਅਤੇ ਉਹ ਕਿੰਨੀ ਦੇਰ ਤੱਕ ਪਾਂਦੇ ਰਹੇ ਅਤੇ ਇਹ ਮ ਸਾਰਿਆਂ ਨੂੰ ਬੜਾ ਪਸੰਦ ਆਇਆ ਸਵੈਟਰ ਕਿ ਇਹ ਬਹੁਤ ਵਧੀਆ ਬਣਾਇਆ ਹੈ ਅਤੇ ਇਹਦੀ ਪ੍ਰੈਕਟਿਸ ਲਈ ਵੀ ਮੈਨੂੰ ਕੋਈ ਜ਼ਿਆਦਾ ਟੈਮ ਨਹੀਂ ਲੱਗਾ ਮੈਂ ਉਹ ਬਣਾਉਂਦੀ ਰਹੀ ਬਣਾਉਂਦੀ ਰਹੀ ਸਿੱਖਿਆ ਅਤੇ ਸ਼ਾਮ ਤੱਕ ਮੈਨੂੰ ਚੰਗੀ ਤਰ੍ਹਾਂ ਇਹ ਬਣਾਉਣਾ ਆ ਗਿਆ ਫਿਰ ਮੈਂ ਇਸ ਤਰ੍ਹਾਂ ਕਿੰਨੇ ਹੀ ਹੋਰ ਸਵੈਟਰ ਵਗੈਰਾ ਬਣਾ ਦਿੱਤੇ ਜਿਹੜੇ ਸਭ ਨੂੰ ਬੜੇ ਪਸੰਦ ਆਏ ਅਤੇ ਸਾਡੇ ਘਰ ਵਿੱਚ ਦਾਦੀ ਮੰਮੀ ਕਾਫ਼ੀ ਸਵੈਟਰ ਬਣਾਉਂਦੇ ਸੀ ਮੈਂ ਉਨ੍ਹਾਂ ਦੇ ਨਾਲ਼ ਬਣਾਉਣ ਵਿੱਚ ਉਨ੍ਹਾਂ ਦੀ ਮਦਦ ਕਰਦੀ ਸੀ ਇਸ ਤਰ੍ਹਾਂ ਹੌਲੀ ਹੌਲੀ ਮੈਨੂੰ ਕਾਫ਼ੀ ਸਵੈਟਰ ਬਣਾਉਣੇ ਆ ਗਏ ਜਿਵੇਂ ਮੈਂ ਲੋਕਾਂ ਦੇ ਵੀ ਸਵੈਟਰ ਬਣਾਉਣੇ ਸ਼ੁਰੂ ਕਰ ਦਿੱਤੇ ਹੌਲੀ ਹੌਲੀ ਥੋੜ੍ਹਾ ਇਹ ਕੰਮ ਜ਼ਿਆਦਾ ਹੋ ਗਿਆ ਅਤੇ ਇਸ ਲਈ ਇਹ ਮੇਰੇ ਪਰਿਵਾਰ ਵੱਲੋਂ ਦੀ ਰਵਾਇਤ ਸੀ ਇਸ ਕਰਕੇ ਅਸੀਂ ਸਾਰੇ ਜਣੇ ਰਲ਼ ਮਿਲ ਕੇ ਇਹ ਸਵੈਟਰ ਬਣਾਉਂਦੇ ਰਹੇ ਜਿਵੇਂ ਕਈ ਵਾਰੀ ਆਪਣੀ ਭੂਆ ਅਤੇ ਚਾਚੀ ਤਾਈ ਦਾ ਵੀ ਸਵੈਟਰ ਬਣਾਇਆ ਜਿਹਦੇ ਵਿੱਚ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਇਸ ਕਰਕੇ ਇਸ ਕਰਕੇ ਇਹ ਇਹ ਚੀਜ਼ ਬਣਾਉਣ ਨੂੰ ਕੋਈ ਜ਼ਿਆਦਾ ਟੈਮ ਨਹੀਂ ਲੱਗਾ ਅਤੇ ਕਾਫ਼ੀ ਪ੍ਰੈਕਟਿਸ ਵੀ ਹੋ ਗਈ ਅਤੇ ਮੈਂ ਕਾਫ਼ੀ ਜ਼ਿਆਦਾ ਥੋੜ੍ਹਾ ਕੰਮ ਵੀ ਕਰ ਲਿਆ ਬਣਾਉਣ ਵਿੱਚ